ਜੀ ਹਾਂ ਇੱਕ ਸਿੱਖਿਅਤ ਵਿਅਕਤੀ ਦੇ ਵਿਵਹਾਰਾਂ ਵਿੱਚ ਅਤੇ ਸਿਧਾਂਤਾਂ ਦੀ ਪਾਲਣਾ ਕਰਨ ਵਿੱਚ ਇੱਕ ਅਨਐਜੂਕੇਟ ਪਰਸਨ ਨਾਲੋਂ ਵਧੇਰੇ ਵਧੀਆ ਹੁੰਦੀ ਹੈ ਜੋ ਕਿ ਸਿੱਖਿਅਤ ਵਿਅਕਤੀ ਹੁੰਦਾ ਹੈ ਉਸ ਦੇ ਵਿਵਹਾਰਾਂ ਵਿੱਚ ਬਹੁਤ ਹੀ ਅੰਤਰ ਪਾਇਆ ਜਾਂਦਾ ਹੈ ਜਿਵੇਂ ਸਹਿਣਸ਼ੀਲਤਾ ਨੇਕ ਦਿਲੀ ਸਹਿਣਸ਼ਕਤੀ ਇਹਨਾਂ ਵਿੱਚ ਵਧੇਰੇ ਪਾਈ ਜਾਂਦੀ ਹੈ ਅਤੇ ਜੋ ਅਨਐਜੂਕੇਟ ਅਣਸਿੱਖਿਅਤ ਵਿਅਕਤੀ ਹੋਵੇਗਾ ਉਸ ਵਿੱਚ ਇਹ ਮਾਤਰਾ ਨੇਕ ਦਿਲੀ ਸਹਿਣਸ਼ੀਲਤਾ ਦੀ ਮਾਤਰਾ ਵਧੇਰੇ ਰੂਪ ਵਿੱਚ ਘੱਟ ਪਾਈ ਜਾਂਦੀ ਹੈ ਇਹਨਾਂ ਦੀ ਸੋਚ ਵਿੱਚ ਬਹੁਤ ਜ਼ਿਆਦਾ ਅੰਤਰ ਪਾਇਆ ਜਾਂਦਾ ਹਨ ਜੋ ਸਿੱਖਿਅਤ ਵਿ ਵਿਅਕਤੀ ਹੋਵੇਗਾ ਉਸ ਦੀ ਸੋਚ ਆਪਣੇ ਸਮਾਜ ਨੂੰ ਅਗਾਂਹ ਲੈ ਕੇ ਜਾਣ ਦੀ ਹੋਵੇਗੀ ਅਤੇ ਜੋ ਅਣਸਿੱਖਿਅਤ ਵਿਅਕਤੀ ਹੋਵੇਗਾ ਉਸ ਦੀ ਸੋਚ ਅਜੇ ਵੀ ਪਛੜੇ ਇਲਾਕੇ ਵਾਂਗ ਪੱਛੜੀ ਹੀ ਹੋਵੇਗੀ ਜੋ ਸਿੱਖਿਅਤ ਵਿਅਕਤੀ ਹੈ ਉਸ ਦੇ ਵਿਚਾਰਾਂ ਵਿੱਚ ਅਣਸਿੱਖਿਅਤ ਵਿਅਕਤੀ ਦੇ ਵਿਚਾਰਾਂ ਨਾਲੋਂ ਵਧੇਰੇ ਰੂਪ ਵਿੱਚ ਮਾਤਰਾ ਵਿੱਚ ਵਾਧਾ ਹੁੰਦਾ ਹੈ ਜੋ ਕਿ ਸੋਚ ਅਤੇ ਸਮਝਣ ਦੀ ਸ਼ਕਤੀ ਵਿੱਚ ਵੀ ਵਧੇਰੇ ਪਾਇਆ ਜਾਂਦਾ ਹੈ ਧੰਨਵਾਦ